ਹਾਂਜੀ ਪਹਿਲਾਂ ਲੋਕ ਸ ਸ ਚਿੱਠੀ ਪੱਤਰ ਲਿਖਦੇ ਸੀ ਹੱਥ ਨਾਲ ਲਿਖਦੇ ਸੀ ਪੰਜਾਬੀ ਭਾਸ਼ਾ ਦੇ ਬਹੁਤ ਤਰੱਕੀ ਕਰ ਰਹੇ ਸੀ ਪਰ ਜਦੋਂ ਮੋਬਾਈਲ ਦਾ ਸਮਾਂ ਆਇਆ ਹੁਣ ਲੋਕ ਜ਼ਿਆਦਾਤਰ ਟਾਈਪ ਕਰਦੇ ਨੇ ਉਹ ਪੰਜਾਬੀ ਘੱਟ ਲਿਖਦੇ ਨੇ ਅਤੇ ਇੰਗਲਿਸ਼ ਦੇ ਵਿੱਚ ਪੰਜਾਬੀ ਨੂੰ ਲਿਖਦੇ ਹਨ ਜਿਹਦੇ ਕਰਕੇ ਪੰਜਾਬੀ ਦਾ ਦਾ ਉੱਨਾਂ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਰਿਹਾ ਜਿੰਨਾਂ ਕਿ ਪਹਿਲਾਂ ਸੀ ਸਾਡੇ ਵਿਦਿਆਰਥੀ ਪੰਜਾਬੀ ਲਿਖਣੀ ਵੀ ਭੁੱਲ ਰਹੇ ਨੇ ਓਹ ਜ਼ਿਆਦਾਤਰ ਪੰਜਾਬੀ ਲਿਖਦੇ ਲਿਖਦੇ ਨਾਲ ਨਾਲ ਇੰਗਲਿਸ਼ ਲਿਖਦੇ ਨੇ ਜਾਂ ਉਹ ਕਿਸੇ ਹੋਰ ਭਾਸ਼ਾ ਦਾ ਸ਼ਬਦ ਲਿਖ ਜਾਂਦੇ ਨੇ ਜਿਹਦੇ ਕਰਕੇ ਪੰਜਾਬੀ ਨੂੰ ਓਨੀ ਤਰੱਕੀ ਨਹੀਂ ਮਿਲ ਰਹੀ ਜਿੰਨੀ ਕਿ ਪਹਿਲਾਂ ਮਿਲ ਮਿਲਦੀ ਸੀ